ਹਾਂਜੀ ਮੈਂ ਆਨਲਾਈਨ ਇੱਕ ਫੇਸਵੋਸ਼ ਅਤੇ ਮੇਕਅਪ ਕਿੱਟ ਖਰੀਦੀ ਹੈ ਫੇਸਵੋਸ਼ ਜੋ ਕਿ ਮੈਂ ਖਰੀਦਿਆ ਸੀਗਾ ਆਨਲਾਈਨ ਉਹ ਬਹੁਤ ਜ਼ਿਆਦਾ ਵਧੀਆ ਸੀਗਾ ਅਤੇ ਜਿਸ ਦੇ ਨਾਲ ਮੇਰੀ ਸਕਿਨ ਜਿਹੜੀ ਕਿ ਡਰਾਈ ਹੁੰਦੀ ਸੀਗੀ ਉਹ ਹੁਣ ਸੋਫਟ ਹੋ ਚੁੱਕੀ ਹੈਗੀ ਆਗੀ ਅਤੇ ਸਕਿੰਨ ਨੂੰ ਕਲੀਨ ਕਰਨ ਦੇ ਵਿੱਚ ਵੀ ਉਹ ਫੇਸਵੋਸ਼ ਬਹੁਤ ਵਧੀਆ ਮਤਲਬ ਕਿ ਹੈਗਾ ਸੀ ਅਤੇ ਉਸ ਦੇ ਨਾਲ ਹੀ ਮੈਂ ਹੋਰ ਵੀ ਕਾਫੀ ਚੀਜ਼ਾਂ ਆਨਲਾਈਨ ਖਰੀਦੀਆਂ ਹਨ ਸਾਰੀਆਂ ਹੀ ਚੀਜ਼ਾਂ ਦੀ ਆਪਣੀ ਆਪਣੀ ਕੁਆਲਿਟੀ ਹੁੰਦੀ ਹੈ ਅਤੇ ਸਾਰੀਆਂ ਹੀ ਚੀਜ਼ਾਂ ਬਹੁਤ ਵਧੀਆ ਪਾਈਆਂ ਜਾਂਦੀਆਂ ਹਨ ਇਸ ਲਈ ਆਨਲਾਈਨ ਕੋਈ ਵੀ ਚੀਜ਼ ਖਰੀਦਣ ਦੇ ਵਿੱਚ ਕੁਛ ਵੀ ਗਲਤ ਨਹੀਂ ਹੈ ਜੇਕਰ ਆਪਾਂ ਆਨਲਾਈਨ ਕੁਛ ਵੀ ਖਰੀਦਦੇ ਹਾਂ ਤਾਂ ਉਸ ਦੇ ਨਾਲ ਆਪਣਾ ਸਮਾਂ ਵੀ ਬਚਦਾ ਹੈ ਅਤੇ ਪੈਸਾ ਵੀ ਘੱਟ ਤੋਂ ਘੱਟ ਬਚ ਸਕਦਾ ਹੈ